ਬਿਮਾਰੀ ਤੋਂ ਬਚਣ ਅਤੇ ਸਿਹਤਮੰਦ ਰਹਿਣ ਲਈ ਅਸੀਂ ਸਾਫ ਸੁਥਰਾ ਭੋਜਨ ਖਾਣ ਦੀ ਕੋਸ਼ਿਸ਼ ਕਰਦੇ ਹਾਂ ਸਮੇਂ ਸਿਰ ਖਾਣ ਦੀ ਕੋਸ਼ਿਸ਼ ਕਰਦੇ ਹਾਂ ਅਤੇ ਘਰ ਦੇ ਵਿੱਚ ਬਣਾਇਆ ਹੋਇਆ ਖਾਣ ਦੀ ਕੋਸ਼ਿਸ਼ ਕਰਦੇ ਹਾਂ ਇਸ ਦੇ ਨਾਲ ਹੀ ਮੌਸਮ ਦੇ ਅਨੁਸਾਰ ਜਿਸ ਤਰ੍ਹਾਂ ਦਾ ਭੋਜਨ ਖਾਣਾ ਚਾਹੀਦਾ ਉਸ ਤਰ੍ਹਾਂ ਹੀ ਖਾਧਾ ਜਾਂਦਾ ਹੈ ਜਿਵੇਂ ਇੱਥੋਂ ਦੇ ਸਾਡੇ ਸਥਾਨਕ ਲੋਕ ਜਿਹੜੇ ਨੇ ਉਹ ਸੈਰ ਜ਼ਰੂਰ ਕਰਦੇ ਨੇ ਆਪਣੇ ਸਮੇਂ ਦੇ ਵਿੱਚੋਂ ਸਮਾਂ ਕੱਢਦੇ ਨੇ ਜਿਸ ਤਰ੍ਹਾਂ ਮੰਨ ਲਉ ਹੁਣ ਸਰਦੀਆਂ ਦਾ ਮੌਸਮ ਚੱਲ ਰਿਹਾ ਤਾਂ ਉਹ ਸਰਦੀ ਤੋਂ ਬਚਣ ਲਈ ਤਾਂ ਕਿ ਠੰਡ ਨਾ ਲੱਗੇ ਕਿਸੇ ਤਰ੍ਹਾਂ ਦੀ ਉਸ ਤਰ੍ਹਾਂ ਦੀ ਬਿਮਾਰੀ ਦਾ ਸ਼ਿਕਾਰ ਨਾ ਹੋਣ ਤਾਂ ਉਹ ਅਲਸੀ ਦੀਆਂ ਪਿੰਨੀਆਂ ਬਣਾ ਲੈਂਦੇ ਨੇੇ ਵੇਸਣ ਬਣਾ ਲੈਂਦੇ ਨੇ ਜਾਂ ਫਿਰ ਮੇਥੇ ਬਣਾ ਲੈਂਦੇ ਨੇ ਘਰਾਂ ਦੇ ਵਿੱਚ ਖੋਆ ਮਾਰ ਲੈਂਦੇ ਨੇ ਇਸ ਤਰ੍ਹਾਂ ਗਰਮੀਆਂ ਦੇ ਵਿੱਚ ਉਹ ਨਾਰੀਅਲ ਪਾਣੀ ਜ਼ਰੂਰ ਪੀਂਦੇ ਨੇ ਜੋ ਵੀ ਫਰੂਟ ਸਸਤਾ ਮੁਹੱਈਆ ਹੁੰਦਾ ਉਹ ਖਾਂਦੇ ਨੇ ਹਰੀਆਂ ਸਬਜ਼ੀਆਂ ਖਾਣ ਦੀ ਕੋਸ਼ਿਸ਼ ਕਰਦੇ ਨੇ